ਹਾਂਜੀ ਸਤਿ ਸ਼੍ਰੀ ਅਕਾਲ ਜੀ ਰਵਾਇਤੀ ਪੰਜਾਬੀ ਜੁੱਤੀ ਬਣਾਉਣ ਦੀ ਕਲਾ ਸਾਡੇ ਪੰਜਾਬ ਵਿੱਚ ਬਹੁਤ ਪ੍ਰਚਲਿਤ ਹੈ ਇਹ ਕਲਾ ਸਾਡੀ ਇੱਕ ਅਲੱਗ ਵਰਗ ਜਿਵੇਂ ਸਾਡੇ ਭਾਈਚਾਰਾ ਜਿਨਾਂ ਨੂੰ ਰਵਿਦਾਸ ਭਾਈਚਾਰਾ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਇਸ ਕਲਾ ਦਾ ਬਖੂਬੀ ਗਿਆਨ ਹੈ ਤੇ ਉਹ ਇਸ ਕਲਾ ਨੂੰ ਬਖੂਬੀ ਨਿਭਾ ਵੀ ਰਹੇ ਹਨ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਜੁੱਤੀਆਂ ਪੇਸ਼ ਕਰਦੇ ਨੇ ਜਿਨਾਂ ਨੂੰ ਪੰਜਾਬ ਦੇ ਲੋਕ ਬਹੁਤ ਹੀ ਜਿਆਦਾ ਪਸੰਦ ਕਰਦੇ ਨੇ ਤੇ ਅਕਸਰ ਹੀ ਉਹਨਾਂ ਨੂੰ ਵਿਆਹਾਂ ਸ਼ਾਦੀਆਂ ਵਿੱਚ ਪਾਉਣਾ ਪਸੰਦ ਕਰਦੇ ਨੇ ਜੁੱਤੀਆਂ ਦੀ ਅਲੱਗ ਅਲੱਗ ਵਰਾਈਟੀ ਮਿਲਦੀ ਹੈ ਤੇ ਜੁੱਤੀਆਂ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਜਿੱਦਾਂ ਕਹਿ ਸਕਦੇ ਆ ਕਿ ਬਹੁਤ ਹੀ ਗਾਣੇ ਵੀ ਪ੍ਰਚਲਿਤ ਹਨ ਜਿੱਦਾਂ ਕਿ ਬਹੁਤ ਪੁਰਾਣਾ ਇੱਕ ਗਾਣਾ ਮਸ਼ਹੂਰ ਹੋਇਆ ਸੀ ਜੁੱਤੀ ਕਸੂਰੀ ਪੈਰ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਇਸ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੀਆਂ ਜੁੱਤੀਆਂ ਜਿਵੇਂ ਮੁਕਤਸਰੀ ਜੁੱਤੀ ਬਹੁਤ ਪ੍ਰਚਲਿਤ ਹੈ ਇਹ ਕਾਫੀ ਜੁੱਤੀਆਂ ਜਿਨਾਂ ਦੇ ਅੰਦਰ ਵੀ ਕੜਾਈ ਕੀਤੀ ਜਾਂਦੀ ਹੈ ਤੇ ਬਾਹਰ ਵੀ ਕੜਾਹੀ ਕੀਤੀ ਜਾਂਦੀ ਹੈ ਤੇ ਬੈਲਵਟ ਦੀ ਜੁੱਤੀ ਆਮ ਜੁੱਤੀ ਨੋਕ ਆਲੀ ਜੁੱਤੀ ਬਹੁਤ ਤਰ੍ਹਾਂ ਦੀਆਂ ਵਰਾਇਟੀਆਂ ਪੰਜਾਬ ਵਿੱਚ ਮਿਲਦੀਆਂ ਨੇ ਜੋ ਕਿ ਲੋਕ ਬਹੁਤ ਪਸੰਦ ਕਰਦੇ ਹਨ ਧੰਨਵਾਦ ਜੀ